ਹਾਂਜੀ ਸ ਸਾਡੀ ਰੋਜ਼ੀ ਰੋਟੀ ਬਿਲਕੁਲ ਬਿਜਲੀ 'ਤੇ ਨਿਰਭਰ ਕਰਦੀ ਹੈ ਸਭ ਤੋਂ ਪਹਿਲਾਂ ਖੇਤੀਬਾੜੀ ਸਮੇਂ ਭਾਵ ਅਨਾਜ ਦੀ ਬਿਜਾਈ ਤੋਂ ਕਟਾਈ ਪੀਸਾਈ ਤੱਕ ਬਿਜਲੀ ਲੋੜੀਂਦੀ ਹੈ ਸਭ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਜ਼ਮੀਨ ਨੂੰ ਪਾਣੀ ਦੇਣ ਲਈ ਪਾਣੀ ਵਾਸਤੇ ਟਿਊਬਲ ਹਨ ਜੋ ਬਿਜਲੀ ਦੀ ਵਰਤੋਂ ਨਾਲ ਚੱਲਦੇ ਹਨ ਫੇਰ ਅਨਾਜ ਦੀ ਪੀਸਾਈ ਤੋਂ ਲੈ ਕੇ ਘਰ ਵਿੱਚ ਰੋਟੀ ਬਣਾਉਣ ਲਈ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਘਰ ਵਿੱਚ ਮਿਕਸੀ ਇਡੰਕਸ਼ਨ ਆਦਿ ਲਈ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬਿਜਲੀ ਕੱਟ ਦੌਰਾਨ ਸਾਡੇ ਸਾਰੇ ਹੀ ਕੰਮ ਪ੍ਰਭਾਵਿਤ ਹੁੰਦੇ ਹਨ ਬਿਜਲੀ ਕੱਟਾਂ ਦੌਰਾਨ ਸਾਨੂੰ ਆਪਣੇ ਕੰਮ ਹੱਥੀਂ ਕਰਨੇ ਪੈਂਦੇ ਹਨ ਜਿਵੇਂ ਮਿਕਸੀ ਦੀ ਥਾਂ ਮਸਾਲਾ ਹੱਥ ਨਾਲ ਪੀਸਣਾ ਪੈਂਦਾ ਹੈ ਜਿਸ ਵਿੱਚ ਸਮਾਂ ਵੱਧ ਲੱਗਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਰੋਸ਼ਨੀ ਲਈ ਵੀ ਬਿਜਲੀ ਦੀ ਲੋੜ ਹੁੰਦੀ ਹੈ ਬਿਜਲੀ ਕੱਟ ਦੌਰਾਨ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਸਾਰੇ ਕੰਮ ਸਹੀ ਤਰੀਕੇ ਨਾਲ ਹੋ ਸਕਣ ਹਾਂ ਜੀ ਲੋਕਾਂ ਕੋਲ ਬਿਜਲੀ ਕੱਟਾਂ ਦੌਰਾਨ ਸਾਰਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਇਨਵਰਟਰ ਦੀ ਉਪਲਬਧ ਹਨ ਜਿਨ੍ਹਾਂ ਨਾਲ ਬਿਜਲੀ ਦੇ ਕੱਟ ਦੌਰਾਨ ਬਿਜਲੀ ਦੀ ਘਾਟ ਜ਼ਿਆਦਾ ਮਹਿਸੂਸ ਨਹੀਂ ਹੁੰਦੀ